ਜਿਸ ਤਰ੍ਹਾਂ ਕਿ ਅਸੀਂ ਪੰਜਾਬ ਦੇ ਵਸਨੀਕ ਹਾਂ ਅਤੇ ਪੰਜਾਬ 'ਚ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਬਹੁਤ ਮਸ਼ਹੂਰ ਹੁੰਦਾ ਹੈ ਅਤੇ ਹਰੇਕ ਪੰਜਾਬੀ ਦੀ ਇੱਕ ਪਸੰਦ ਹੁੰਦਾ ਪਹਿਲ ਹੀ ਹੁੰਦੀ ਹੈ ਕਿ ਮੱਕੀ ਰੋਟੀ ਹੋਵੇ ਸਾਗ ਹੋਵੇ ਮੱਖਣ ਹੋਵੇ ਲੱਸੀ ਹੋਵੇ ਠੀਕ ਹੈ ਅਤੇ ਇਹ ਜੋ ਮੱਕੀ ਦੀ ਰੋਟੀ ਹੈ ਨਾ ਇਹ ਮੈਂ ਆਪਣਾ ਇੱਕ ਤਜ਼ਰਬਾ ਜੋ ਮੇਰਾ ਐਕਸਪੀਰੀਅੰਸ ਹੈ ਉਹ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜੋ ਜੋ ਮੱਕੀ ਦੀ ਰੋਟੀ ਉਹ ਮੈਨੂੰ ਵਿਆਹ ਤੋਂ ਪਹਿਲਾਂ ਨਹੀਂ ਸੀ ਬਣਾਉਣੀ ਆਉਂਦੀ ਆਣੀ ਆਉਂਦੀ ਅਤੇ ਇਹ ਮੈਂ ਵਿਆਹ ਤੋਂ ਬਾਅਦ ਸਿੱਖੀ ਮੇਰੀ ਸੱਸ ਮਾਂ ਨੇ ਮੈਨੂੰ ਰੋਟੀ ਬਣਾਉਣੀ ਸਿਖਾਈ ਸੀ ਔਰ ਮੈਨੂੰ ਐਨੇ ਅੱਛੀ ਉਹ ਰੋਟੀ ਬਣਾਉਣੀ ਸਿਖਾਈ ਕਿ ਅੱਜ ਹਰ ਕੋਈ ਮੇਰੀ ਮੱਕੀ ਰੋਟੀ ਖਾਣਾ ਪਸੰਦ ਕਰਦਾ ਹ ਸਾਰੇ ਹੈਰਾਨ ਹੁੰਦੇ ਮੇਰੀ ਮੱਕੀ ਰੋਟੀ ਨੂੰ ਦੇਖ ਕੇ ਕਿਉਂਕਿ ਮੇਰੀ ਜੋ ਮੱਕੀ ਦੀ ਰੋਟੀ ਬਹੁਤ ਹੀ ਪਤਲੇ ਪਣ 'ਚ ਬਣਦੀ ਹੈ ਕਿ ਇਹ ਸਾਰੇ ਕਹਿਣਗੇ ਕਿ ਇਹ ਤਾਂ ਇੱਕ ਤਰ੍ਹਾਂ ਦਾ ਫੁਲਕਾ ਹੀ ਲੱਗਦਾ ਹੈ ਤਾਂ ਮੈਨੂੰ ਸਾਰੇ ਪੁੱਛਣਗੇ ਤੂੰ ਕ ਓ ਬਣਾਉਂਦੀ ਕਿਸ ਤਰ੍ਹਾਂ ਹੈ ਪਰ ਬਣਾਉਣ ਦਾ ਮੈਥੜ ਤਾਂ ਸਾਰਾ ਉਹੀ ਸੇਮ ਜਿਸ ਤਰ੍ਹਾਂ ਬਾਕੀ ਬਣਾਉਂਦੇ ਹਨ ਅਤੇ ਪਰ ਇਹ ਹੈ ਕਿ ਬਾਕੀ ਜਿਸ ਤਰ੍ਹਾਂ ਮੱਕੀ ਦੀ ਰੋਟੀ ਥੋੜ੍ਹੇ ਮੋਟੇ ਪਣ 'ਚ ਬਣਾਉਂਦੇ ਆ ਪਰ ਜੋ ਮੇਰੀ ਮੱਕੀ ਦੀ ਰੋਟੀ ਉਹ ਪਤਲੀ ਹੁੰਦੀ ਉਹ ਸਾਰਿਆਂ ਨੂੰ ਬਹੁਤ ਕ੍ਰਿਸਪੀ ਲੱਗਦੀ ਖਾਣ ਵਿੱਚ ਕਿ ਜਿਹਨੇ ਇੱਕ ਖਾਣੀ ਹੁੰਦੀ ਉਹ ਮੇਰੇ ਹਿਸਾਬ ਨਾਲ ਦੋ ਹੀ ਖਾ ਕੇ ਜਾਂਦਾ ਆ ਤਾਂ ਮੇਰਾ ਇਹੀ ਐਕਸਪੀਰੀਅੰਸ ਹੈ ਕਿ ਮੱਕੀ ਦੀ ਰੋਟੀ ਜੇ ਉਹ ਹੈ ਉਹ ਬਹੁਤ ਅੱਛੀ ਮੈਂ ਬਣਾ ਲੈਂਦੀ ਹਾਂ